ਆਮ ਨਾਗਰਿਕਾ ਦੀ ਸੁਰੱਖਿਆ ਲਈ ਅਤੇ ਸ਼ਾਂਤੀ ਬਣਾਈ ਰੱਖਣ ਲਈ ਅਸੀਂ ਦੇਖਦੇ ਹਾਂ ਵੀ ਜਿਹੜਾ ਗਰੀਬ ਬੰਦਾ ਉਹਨੂੰ ਕਾਨੂੰਨ ਪ੍ਰਣਾਲੀ ਬੜੀ ਸਸਤੀ ਸਹਾਇਤਾ ਉਹਨੂੰ ਮਿਲਣੀ ਚਾਹੀਦੀ ਹੈ ਉਹਨੂੰ ਸਰਕਾਰ ਵੱਲੋਂ ਕੋਈ ਬਦਲਵੇ ਪ੍ਰਬੰਧ ਕਰਕੇ ਦੇਣੇ ਚਾਹੀਦੀ ਜਿਹਦੇ ਵਿੱਚ ਉਹਨੂੰ ਟੋਲ ਫਰੀ ਨੰਬਰ ਆਪਣੀ ਸਮੱਸਿਆ ਦੇ ਹੱਲ ਲਈ ਲਾਉਣੇ ਚਾਹੀ ਦੇਣੇ ਚਾਹੀਦੇ ਨੇ ਰਿਸ਼ਵਤਖੋਰੀ ਨੂੰ ਰੋਕਣ ਲਈ ਸਰਕਾਰ ਨੂੰ ਕਈ ਦਫਤਰਾਂ ਵਿੱਚ ਕੈਮਰੇ ਵਗੈਰਾ ਲਾਉਣੇ ਚਾਹੀਦੇ ਨੇ ਜਿਨ੍ਹਾਂ ਦਾ ਪ੍ਰਬੰਧ ਇਮਾਨਦਾਰ ਅਫਸਰਾਂ ਨੂੰ ਦੇਣਾ ਚਾਹੀਦਾ ਅਤੇ ਸਰਕਾਰ ਨੂੰ ਪੁਲਿਸ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਇਮਾਨਦਾਰ ਅਫਸਰਾਂ ਨੂੰ ਲਾਉਣਾ ਚਾਹੀਦਾ ਅਸੀਂ ਦੇਖਿਆ ਕਿ ਜਿਹੜੀ ਰਿਸ਼ਵਤਖੋਰੀ ਆ ਉਹ ਅਪਰਾਧ ਨੂੰ ਏ ਜਨਮ ਦੇ ਰਹੀ ਹੈ ਕਈ ਅਫ਼ਸਰ ਜਿਹੜੀ ਬਿਊਰੋਕਰੇਸੀ ਹੈ ਉਹ ਉਹਦਾ ਰਿਸ਼ਤਾ ਜਿਹੜਾ ਜਿਹੜਾ ਕਰੀਮੀਨਲ ਉਹਨਾਂ ਨਾਲ ਬੜਾ ਵੱਧਦਾ ਜਾ ਰਿਹਾ ਇਸ ਲਈ ਸਰਕਾਰ ਨੂੰ ਇਹ ਸਭ 'ਤੇ ਨਿਗਾਹ ਰੱਖਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਨਜਿੱਠਿਆ ਜਾ ਸਕਦਾ ਇਹਨਾਂ ਨੂੰ ਅਤੇ ਵਿਸ਼ੇਸ਼ ਟ੍ਰੇਨਿੰਗ ਵਿਸ਼ੇਸ਼ ਭਰਤੀ ਅਤੇ ਸਰਕਾਰ ਨੂੰ ਇਹ ਚੀਜ਼ਾਂ ਕੈਮਰੇ ਟੋਲ ਫਰੀ ਨੰਬਰ ਲਾਉਣੇ ਚਾਹੀਦੇ ਨੇ